ਹੈਲੋ ਅਨੇਜਾ ਸਵੀਟਸ ਜੀ ਸਰ ਸਤਿ ਸ਼੍ਰੀ ਅਕਾਲ ਮੈਂ ਰਾਮ ਲਾਲ ਬੋਲ ਰਿਹਾ ਜੀ ਸਰ ਹਾਊਸ ਨੰਬਰ ਸੱਤ ਏ ਕਾਕਾ ਕਲੌਨੀ ਨਜ਼ਦੀਕ ਤੇਈ ਨੰਬਰ ਫਾਟਕ ਤੋਂ ਸਰ ਸਰ ਸਵੇਰੇ ਮੈਂ ਮੇਰੇ ਘਰ ਕੁਛ ਗੈਸਟਾਂ ਨੇ ਆਉਣਾ ਸੀ ਮੈਂ ਇੱਕ ਛੋਟੀ ਜਿਹੀ ਪਾਰਟੀ ਰੱਖੀ ਸੀ ਅਤੇ ਮੈਂ ਸਵੇਰੇ ਬ੍ਰੇਕਫਾਸਟ ਲਈ ਕੁਛ ਤੁਹਾਡੇ ਕੋਲ ਆਈਟਮਾਂ ਲਿਖਾਈਆਂ ਸੀਗੀਆਂ ਜਿਹਦੇ ਵਿੱਚ ਕੁਛ ਪ੍ਰੋਂਠੀਜ਼ ਸਬਜੀਜ਼ ਅਤੇ ਕਰਡ ਵਗੈਰਾ ਸੀ ਸੋ ਤੁਹਾਡਾ ਡਿਲੀਵਰੀ ਬੋਆਏ ਜਦੋਂ ਆਇਆ ਅਤੇ ਉਸਨੇ ਮੈਨੂੰ ਜੋ ਵੀ ਸਮਾਨ ਦਿੱਤਾ ਸਰ ਉਹਦੇ ਵਿੱਚ ਮੈਨੂੰ ਸਾਰਾ ਤਕਰੀਬਨ ਬੇਕਰੀ ਦਾ ਸਮਾਨ ਮਿਲਿਆ ਜੀ ਹਾਲਾਂਕਿ ਪਹਿਲਾਂ ਇੱਦਾਂ ਕਦੀ ਨਹੀਂ ਹੋਇਆ ਸਰ ਕਿ ਉਹ ਮੈਨੂੰ ਮਤਲਬ ਐਸੀ ਕੋਈ ਤੁਹਾਡੀ ਡਿਲੀਵਰੀ 'ਚ ਕੋਈ ਪ੍ਰੋਬਲਮ ਆਈ ਹੋਵੇ ਤੁਹਾਡੇ ਫੂਡ 'ਚ ਕੋਈ ਪ੍ਰੋਬਲਮ ਬਹੁਤ ਅੱਛੀ ਸਰਵਿਸ ਹੈ ਤੁਹਾਡੀ ਡਿਲੀਵਰੀ ਬਹੁਤ ਅੱਛੀ ਹੈ ਸੋ ਮੈਂ ਉਸ ਟਾਈਮ ਬੜਾ ਥੋੜ੍ਹਾ ਮੈਨੂੰ ਸ਼ੌਕ ਲੱਗਿਆ ਅਤੇ ਮੈਂ ਜਾ ਕੇ ਨਜ਼ਦੀਕੀ ਕੋਈ ਐਮਰਜੈਂਸੀ ਸੀ ਸਰ ਅਤੇ ਨਜ਼ਦੀਕੀ ਸਟੋਰ ਤੋਂ ਮੈਂ ਇਹ ਚੀਜ਼ਾਂ ਉਪਲਬਧ ਕਰੀਆ ਜੀ ਅਤੇ ਉਸ ਤੋਂ ਬਾਅਦ ਮੈਂ ਆਪਣਾ ਇਹ ਸਰਕਲ ਚਲਾਇਆ